ਮੁਹਾਵਰੇ ਕਿਸੇ ਵੀ ਭਾਸ਼ਾ ਦਾ ਸ਼ਿੰਗਾਰ ਹੁੰਦੇ ਹਨ ਪੰਜਾਬੀ ਭਾਸ਼ਾ ਵਿੱਚ ਅਨੇਕਾਂ ਹੀ ਮੁਹਾਵਰੇ ਹਨ ਜੋ ਇਸ ਭਾਸ਼ਾ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ ਇਹ ਜੋ ਮੁਹਾਵਰੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਨਿੱਜੀ ਤਜ਼ਰਬਿਆਂ ਵਿੱਚੋਂ ਨਿਕਲ ਕੇ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਹਨ ਮੁਹਾਵਰੇ ਕਈ ਤਰ੍ਹਾਂ ਦੇ ਹਨ ਜਿਵੇਂ ਕਿ ਉਂਗਲ ਕਰਨੀ ਉਂਗਲ ਦਾ ਕਰਨੀ ਦਾ ਮਤਲਬ ਹੁੰਦਾ ਦੋਸ਼ ਲਾਉਣਾ ਜਦੋਂ ਅਸੀਂ ਬਿਨਾਂ ਕਿਸੇ ਸੋਚੇ ਸਮਝੀ ਅਧੀਨ ਕਿਸੇ ਵੱਲ ਉਂਗਲ ਕਰ ਦਿੰਦੇ ਹਾਂ ਤਾਂ ਉਸ ਨੂੰ ਕਹਿ ਦਿੰਦੇ ਹਨ ਉਂਗਲ ਕਰਨੀ ਹੈ ਉੱਨੀ ਇੱਕੀ ਦਾ ਫਰਕ ਜਦੋਂ ਕਿਸੇ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਹੋਵੇ ਅਸੀਂ ਉਹਨੂੰ ਅਕਸਰ ਕਹਿ ਦਿੰਦੇ ਹਾਂ ਵੀ ਉੱਨੀ ਇੱਕੀ ਦਾ ਫਰਕ ਹੈ ਇਹ ਜੋ ਭੈਣ ਭਰਾ ਹਨ ਇਹਨਾਂ ਦੀ ਸ਼ਕਲ ਵਿੱਚ ਉੱਨੀ ਇੱਕੀ ਦਾ ਫਰਕ ਹੈ ਇੱਕ ਪੰਜਾਬੀ ਦਾ ਮੁਹਾਵਰਾ ਹੁੰਦਾ ਹੈ ਉੱਨ ਲਾਉਣੀ ਮਤਲਬ ਕਿ ਖੱਲ ਲਾਉਣੀ ਖੂਬ ਲੁੱਟਣਾ ਜੋ ਡਾਕਟਰ ਲੋਕ ਹਨ ਉਹ ਅਕਸਰ ਹੀ ਜੋ ਮਰੀਜ਼ ਲੋਕ ਉਹਨਾਂ ਕੋਲ ਜਾਂਦੇ ਹਨ ਉਹ ਉਹਨਾਂ ਦੀ ਖੂਬ ਉੁੱਨ ਲਾਉਂਦੇ ਹਨ

ਹਰੀ ਸਿੰਘ ਨਲੂਏ ਨੇ ਜਮਰੌਦ ਦੇ ਕਿਲ੍ਹੇ 'ਤੇ ਚੜ੍ਹਾਈ ਕੀਤੀ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਉਸਨੇ ਇੱਟ ਨਾਲ ਇੱਟ ਖੜਕਾ ਦਿੱਤੀ ਜਾਂ ਅਸੀਂ ਸਰਹੰਦ 'ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਕੀਤਾ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਇੱਟ ਨਾਲ ਇੱਟ ਖੜਕਾ ਦਿੱਤੀ ਇਹ ਮੁਹਾਵਰੇ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਹਨ